ਮੇਰੇ ਬਚਪਨ ਦੀਆਂ ਸਭ ਤੋਂ ਯਾਦਗਾਰ ਯਾਦਾਂ ਮਨਮੋਹਕ ਯਾਦਾਂ ਇੱਕ ਅੱਠ ਵਰ੍ਹੇ ਤੋਂ ਲੈ ਕੇ ਸੋਲਾਂ ਵਰ੍ਹੇ ਤੱਕ ਦੀ ਸੀ ਜਦ ਮੈਂ ਸਕੂਲ ਜਾਂਦੀ ਸੀ ਸਕੂਲ ਦੇ ਆਉਣ ਤੋਂ ਬਾਅਦ ਆਪਣੇ ਸਹੇਲੀਆਂ ਅਤੇ ਆਪਣੇ ਮਿੱਤਰਾਂ ਦੇ ਨਾਲ ਖੇਡਦੀ ਮੈਦਾਨਾਂ ਦੇ ਵਿੱਚ ਖੇਡਦੀ ਨੱਚਦੀ ਟੱਪਦੀ ਅਤੇ ਫੇਰ ਟਿਊਸ਼ਨ ਜਾਂਦੀ ਟਿਊਸ਼ਨ ਤੋਂ ਆ ਕੇ ਫਿਰ ਤੋਂ ਖੇਡਦੀ ਫੇਰ ਪੜ੍ਹਦੀ ਉਸ ਸਮੇਂ ਦੇ ਦੀ ਖਾਸੀਅਤ ਇਹ ਸੀ ਕਿ ਸਾਨੂੰ ਕੋਈ ਤਨਾਵ ਨਹੀਂ ਸੀ ਅਸੀਂ ਆਪਣੀ ਲਾਈਫ ਜਿਦਾਂ ਦੀ ਜੀਣਾ ਚਾਹੁੰਦੇ ਹਾਂ ਜੀ ਰਹੇ ਸੀ ਨਾ ਹੀ ਪੈਸੇ ਕਮਾਉਣ ਦੀ ਦੀ ਹੋੜ ਸੀ ਨਾ ਹੀ ਕਿਸੇ ਹੋਰ ਚੀਜ਼ ਦੀ ਇੱਕ ਰੁਪਏ ਦੇ ਵਿੱਚ ਉਸ ਸਮੇਂ ਬਹੁਤ ਕੁਛ ਮਿਲ ਜਾਂਦਾ ਸੀ ਬਟ ਅੱਜ ਦੇ ਸਮੇਂ ਦੇ ਵਿੱਚ ਇੱਕ ਰੁਪਏ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਕੁਝ ਨਹੀਂ ਮਿਲਦਾ ਉਹ ਸਮੇਂ ਸਾਡਾ ਸਿਰਫ ਖੇਲਣ ਦੇ ਵੱਲ ਅਤੇ ਪੜ੍ਹਨ ਦੇ ਵੱਲ ਜ਼ਿਆਦਾ ਧਿਆਨ ਸੀ ਅਤੇ ਹੋਰ ਕਿਸੇ ਵੱਲ ਨਹੀਂ ਸੀ ਅਤੇ ਅੱਜ ਦੇ ਸਮੇਂ ਦੇ ਵਿੱਚ ਹਰ ਪਾਸੇ ਸਾਡਾ ਦਿਮਾਗ ਘੁੰਮਦਾ ਹੈ ਅਤੇ ਉਹ ਸਮਾਂ ਮੈਨੂੰ ਤਾਂ ਵੀ ਮਨਮੋਹਕ ਲੱਗਦਾ ਹੈ ਕਿਉਂਕਿ ਉਸ ਸਮੇਂ ਸਾਰੇ ਇਕੱਠੇ ਇਕੱਠੇ ਇਕੱਠੇ ਰਹਿੰਦੇ ਸੀ ਜ਼ਿਆਦਾਤਰ ਖੇਡਦੇ ਇਕੱਠੇ ਸੀ ਗਰਮੀਆਂ ਦੀਆਂ ਛੁੱਟੀਆਂ ਅਤੇ ਠੰਡ ਦਾ ਸਮਾਂ ਅਤੇ ਸਾਰੇ ਤਿਉਹਾਰ ਰਲ ਮਿਲ ਕੇ ਨੱਚਦੇ ਟੱਪਦੇ ਅਸੀਂ ਮਨਾਉਂਦੇ ਸੀ ਅਤੇ ਹੋਰ ਵੀ ਬਹੁਤ ਕੁਝ ਧੰਨਵਾਦ